ਹੈਲੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਮੈਂ ਨਾ ਤੁਹਾਡਾ ਨੰਬਰ ਸਰਚ ਕੀਤਾ ਸੀ ਅਤੇ ਮੈਨੂੰ ਪਤਾ ਲੱਗਿਆ ਤੁਸੀਂ ਮਿਊਜ਼ਿਕ ਦੇ ਬਹੁਤ ਉੱਘੇ ਵਿਦਵਾਨ ਓ ਮੈਂ ਨਾ ਤੁਹਾਡੇ ਤੋਂ ਕੁੱਛ ਪੁੱਛਣਾ ਚਾਹੁੰਦੀ ਸੀ ਤੁਸੀਂ ਅੱਜ ਤੱਕ ਕਿੰਨੇ ਫੇਮਸ ਪ੍ਰਸਨੈਲਟੀਆਂ ਨੂੰ ਮਿਲੇ ਓ ਅਤੇ ਮੈਮ ਤੁਸੀਂ ਉਹਨਾਂ ਦੀ ਲਾਈਫ਼ ਤੋਂ ਕੀ ਕੁੱਝ ਸਿੱਖਿਆ ਕਿਵੇਂ ਉਹਨਾਂ ਦੀ ਲਾਈਫ਼ ਚੱਲਦੀ ਹੈ ਹਾਂਜੀ ਮੈਂ ਇਹ ਸਭ ਸੁਣ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਸੀ ਕੀ ਕਿਉਂਕਿ ਨਾ ਮੈਂ ਆਪ ਸੰਗੀਤ ਵਿੱਚ ਬਹੁਤ ਜ਼ਿਆਦਾ ਉਹ ਰੁੱਚੀ ਰੱਖਦੀ ਆ ਫਿਰ ਤੁਸੀਂ ਮੈਮ ਅਸੀਂ ਮੈਮ ਫਿਰ ਅਸੀਂ ਤੁਸੀਂ ਸਾਨੂੰ ਐਡਰੈੱਸ ਸੈਂਡ ਕਰ ਦਿਓ ਅਸੀਂ ਤੁਹਾਡੇ ਐਡਰੈੱਸ 'ਤੇ ਆਵਾਂਗੇ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ